ਮੈਂ ਇੱਥੇ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਅਸੀਂ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਹਜ਼ੂਰ ਸਾਹਿਬ ਸਿਰਡੀ ਇੱਧਰ ਜਾਣ ਦਾ ਜਿਹੜਾ ਪ੍ਰੋਗਰਾਮ ਬਣਾ ਰਹੇ ਹਾਂ ਪਰ ਜਿਹੜਾ ਕੀ ਹੈ ਕਿ ਰੇਲ ਗੱਡੀਆਂ ਦੀ ਜਿਹੜੀ ਕਿਵੇਂ ਬੁਕਿੰਗ ਕਰਨੀ ਹੈ ਕੀ ਕੀ ਜਿਸ ਦਿਨ ਅਸੀਂ ਜਾਣਾ ਉਪਲਬਧ ਹੋਣਗੀਆਂ ਕਿੱਥੇ ਸਾਡਾ ਅਰਾਈਵ ਹੈ ਕਿੱਥੇ ਸਾਡਾ ਡਿਪਾਰਚਰ ਹੈਗਾ ਇਹ ਸਾਰੀਆਂ ਚੀਜ਼ਾਂ ਦਾ ਵੇਖਣਾ ਵੀ ਜਦੋਂ ਛੁੱਟੀਆਂ ਹੋਣਗੀਆਂ ਵੀ ਉਦੋਂ ਸਾਨੂੰ ਕਿਹੜੀ ਟ੍ਰੇਨ ਹੈ ਜਿਹੜੀ ਸੂਟੇਬਲ ਹੋਊਗੀ ਜਾਂ ਨਹੀਂ ਹੋਊਗੀ ਇਸਦੇ ਲਈ ਜਿਹੜਾ ਕਿ ਮੈਂ ਉਲਝਣ ਦੇ ਵਿੱਚ ਸੀ ਤਾਂ ਜਿਹੜਾ ਕਿ ਮੈਂ ਆਪਦੇ ਇੱਕ ਫਰੈਂਡ ਨੂੰ ਕੌਲ ਕੀਤੀ ਮੇਰਾ ਫਰੈਂਡ ਬਹੁਤ ਐਕਸਪਰਟ ਹੈ ਉਹ ਆਮ ਤੌਰ 'ਤੇ ਜਿਹੜਾ ਕਿ ਆਉਂਦਾ ਜਾਂਦਾ ਰਹਿੰਦਾ ਹੈਗਾ ਰੇ ਟਰੇਨ ਰੇਲ ਗੱਡੀ ਦੇ ਉੱਪਰ ਟਿਕਟਾਂ ਬੁੱਕ ਕਰਨੀਆਂ ਕਿਹੜੀ ਟ੍ਰੇਨ ਦਾ ਕਿੰਨਾ ਨੰਬਰ ਹੈ ਕਿਹੜੀ ਸ਼ਤਾਬਦੀ ਹੈ ਕਿਹੜੀ ਐਕਸਪਰੈਸ ਹੈ ਕਿਹੜੀ ਸੀਟ ਦੀ ਬੁਕਿੰਗ ਕਰਨੀ ਹੈ ਏ ਸੀ ਫਸਟ ਕਲਾਸ ਕਰਨੀ ਹੈ ਸੈਕਿੰਡ ਕਲਾਸ ਕਰਨੀ ਹੈ ਜਾਂ ਕਿਹੜੀ ਕਰਨੀ ਹੈ ਕਿਹੜੀ ਸਾਨੂੰ ਸੌਖੀ ਰਹੇਗੀ ਅਤੇ ਨਾਲ ਨਾਲ ਇਹ ਚੀਜ਼ਾਂ ਵੀ ਮੈਂ ਉਹਨੂੰ ਨਾਲ ਡਿਸਕਸ ਕੀਤੀਆਂ ਵੀ ਅਸੀਂ ਪੰਜ ਮੈਂਬਰ ਐਂਗੇ ਪੰਜ ਅਸੀਂ ਘਰਦੇ ਹਾਂ ਪੰਜ ਸਾਡੇ ਨਾਲ ਰਿਸ਼ਤੇਦਾਰ ਹੋਣਗੇ ਅਤੇ ਇੱਕ ਤੂੰ ਵੀ ਸਾਡੇ ਨਾਲ ਚੱਲੀ ਵੀ ਤੂੰ ਵੀ ਆਪਦੀ ਟਿਕਟ ਬੁੱਕ ਕਰ ਲਈ ਵੀ ਇੰਨੀਆਂ ਸੀਟਾਂ ਜਿਹੜੀਆਂ ਸਾਨੂੰ ਸੈਕਿੰਡ ਏ ਸੀ ਦੇ ਵਿੱਚ ਆਪਾਂ ਲੈਣੀ ਹੈਗੀ ਵੀ ਚੰਗੀ ਤਰ੍ਹਾਂ ਨਾਲ ਤੂੰ ਦੇਖ ਜਿਹੜਾ ਪੱਚੀ ਦਸੰਬਰ ਨੂੰ ਆਪਾਂ ਚੱਲਣਾ ਹੈਗਾ ਵੀ ਕੀ ਪੱਚੀ ਦਸੰਬਰ ਨੂੰ ਇਹ ਸੀਟਾਂ ਸਾਨੂੰ ਉਪਲਬਧ ਹੋ ਜਾਣਗੀਆਂ ਅਸੀਂ ਬਰਨਾਲਾ ਤੋਂ ਚੜ੍ਹਨਾ ਹੈਗਾ ਵੀ ਸਿੱਧਾ ਬਰਨਾਲਾ ਤੋਂ ਸਿੱਧਾ ਪੂਨੇ ਜਾਣਾ ਹੈਗਾ ਜਾਂ ਸਿੱਧਾ ਹਜ਼ੂਰ ਸਾਹਿਬ ਜੇ ਚੱਲੀਏ ਵੀ ਕਿਹੜੀ ਟ੍ਰੇਨ ਸਾਨੂੰ ਸਹੀ ਰਹੇਗੀ ਅਤੇ ਕਿਹੜੇ ਟਾਈਮ ਰਹੇਗੀ ਅਤੇ ਉਹ ਸਾਰਾ ਜਿਹੜਾ ਕੀ ਹੈਗਾ ਵੀ ਕੀ ਸਾਨੂੰ ਜਿਹੜੀਆਂ ਸੀਟਾਂ ਹੈਗੀਆਂ ਉਹ ਇਕੱਠੀਆਂ ਇੱਕ ਕੰਪਾਰਟ ਦੇ ਵਿੱਚ ਇੱਕ ਡੱਬੇ ਦੇ ਵਿੱਚ ਮਿਲ ਸਕਦੀਆਂ ਹਨ ਜਾਂ ਮਿਲ ਨਹੀਂ ਸਕਦੀਆਂ ਕੀ ਜਿਹੜੀਆਂ ਸੀਟਾਂ ਸਾਨੂੰ ਉੱਪਰ ਨੀਚੇ ਮਿਲਣਗੀਆਂ ਜਾਂ ਨੀਚੇ ਨੀਚੇ ਹੀ ਮਿਲ ਜਾਣ ਆਹਮੋ ਸਾਹਮਣੇ ਹੀ ਮਿਲ ਜਾਣ ਵੀ ਮਤਲਬ ਕਿ ਇੱਕ ਕੰਪਾਟ ਦੇ ਵਿੱਚ ਇੱਕ ਡੱਬੇ ਦੇ ਵਿੱਚ ਮਿਲ ਜਾਣ ਤਾਂ ਸਾਨੂੰ ਜਿਹੜਾ ਕੀ ਹੈ ਸੌਖਾ ਹੋ ਜਾਊਗਾ ਕਿਉਂਕਿ ਸਾਡੇ ਨਾਲ ਬੱਚਿਆਂ ਨੇ ਵੀ ਜਾਣਾ ਗਾ ਕਿਉਂਕਿ ਜਦੋਂ ਨਾਲ ਫੈਮਿਲੀ ਮੈਂਬਰ ਹੋਣਗੇ ਨਾ ਬੱਚਿਆਂ ਨੂੰ ਐਡਜਸਟ ਕਰਨਾ ਉੱਥੇ ਸੌਖਾ ਹੋ ਜਾਂਦਾ ਕਈ ਵਾਰੀ ਜਿਹੜੀਆਂ ਦੂਜੀਆਂ ਸਵਾਰੀਆਂ ਹੁੰਦੀਆਂ ਉਹ ਐਡਜਸਟ ਨਹੀਂ ਕਰਦੀਆਂ ਇਸ ਲਈ ਜਿਹੜਾ ਕੀ ਹੈ ਕਿ ਮੈਂ ਉਹ ਤੋਂ ਬਹੁਤ ਜ਼ਿਆਦਾ ਸਲਾਹ ਮੰਗੀ ਉਸ ਨੇ ਵੀ ਮੈਨੂੰ ਇੱਕ ਦੋ ਐਪਸ ਦੇ ਬਾਰੇ ਦੱਸਿਆ ਟ੍ਰੇਨ ਦੇ ਵੀ ਤੂੰ ਡਾਊਨਲੋਡ ਕਰ ਵੀ ਤੁਸੀਂ ਵੀ ਨਾਲ ਨਾਲ ਦੇਖੀ ਚੱਲੋ ਤਾਂ ਫਿਰ ਮੈਂ ਵੀ ਇੱਕ ਐਪ ਡਾਊਨਲੋਡ ਕੀਤੀ ਉਸ ਦੇ ਵਿੱਚ ਮੈਂ ਵੇਖਿਆ ਵੀ ਇਸ ਤਰੀਕ ਨੂੰ ਪ ਪੱਚੀ ਨੂੰ ਪੱਚੀ ਦਸੰਬਰ ਨੂੰ ਕਿਹੜੀਆਂ ਕਿਹੜੀਆਂ ਟ੍ਰੇਨਸ ਹਜ਼ੂਰ ਸਾਹਿਬ ਜਾ ਰਹੀਆਂ ਹਨ ਕਿੰਨੇ ਟਾਈਮ 'ਤੇ ਜਾਣੀਆਂ ਬਠਿੰਡੇ ਤੋਂ ਚੱਲੂ ਜਾਂ ਗੰਗਾ ਨਗਰ ਤੋਂ ਕਿੱਥੋਂ ਚੱਲਣੀਆਂ ਇਹ ਸਾਰੀਆਂ ਚੀਜ਼ਾਂ ਮੈਂ ਚੈੱਕ ਕਰਦਾ ਗਿਆ ਨਾਲ ਨਾਲ ਮੈਂ ਟਿਕਟ ਬੁਕਿੰਗ ਕਰਨੀ ਵੀ ਸਿੱਖਦਾ ਗਿਆ ਵੀ ਅਸੀਂ ਐਨੇ ਮੈਂਬਰ ਹਾਂ ਐਨਿਆਂ ਦਾ ਕਿੰਨਾ ਕਿਰਾਇਆ ਲੱਗੇਗਾ ਨਾਲ ਆਧਾਰ ਕਾਰਡ ਨੰਬਰ ਮੈਨਸ਼ਨ ਕਰਨਾ ਪੈਂਦਾ ਏਜ ਮੈਨਸ਼ਨ ਕਰਨੀ ਪੈਂਦੀ ਹੈ ਸੀਨੀਅਰ ਸਿਟੀਜਨ ਹੈਗਾ ਜਿਹੜਾ ਕੋਈ ਉਹਦੇ ਬਾਰੇ ਵੀ ਦੱਸਣਾ ਪੈਂਦਾ ਉਹਦਾ ਜਿਹੜਾ ਕੀ ਆ ਫੇਅਰ ਉਹਦਾ ਬਹੁਤ ਘੱਟ ਲੱਗਦਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਉਹਨੇ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਸਮਝਾਇਆ ਅਤੇ ਮੈਨੂੰ ਵੀ ਸਮਝ ਕੇ ਵਧੀਆ ਅੱਛਾ ਲੱਗਿਆ ਕਿਉਂ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਖੁਦ ਨੂੰ ਸਿੱਖ ਲੈਣੀਆਂ ਚਾਹੀਦੀਆਂ ਨੇ ਇਹ ਨਹੀਂ ਵੀ ਆਪਾਂ ਹਰ ਦੂ ਨਿੱਕੀ ਨਿੱਕੀ ਚੀਜ਼ 'ਤੇ ਦੂਜੇ 'ਤੇ ਡਿਪੈਂਡ ਹੋਣਾ ਪਵੇ ਤਾਂ ਉਹਨੇ ਮੈਨੂੰ ਇੱਕ ਵਾਰੀ ਸਮਝਾ ਤਾ ਅਤੇ ਮੈਂ ਚਲੋ ਇੱਕ ਦੋ ਵਾਰੀ ਉਲਝਿਆ ਫਿਰ ਮੈਂ ਕਰਨੀਆਂ ਆਪਣੇ ਆਪ ਸਿੱਖ ਗਿਆ ਤਾਂ ਹੁਣ ਮੈਨੂੰ ਕੋਈ ਔਖਾ ਨਹੀਂ ਲੱਗਾ ਲੱਗਦਾ ਹੈਗਾ ਹੁਣ ਮੈਂ ਜਿਹੜੇ ਆਪਣੇ ਆਪ ਹੀ ਟਿਕਟਾਂ ਜਿਹੀਆਂ ਔਨਲਾਈਨ ਆਪਦੀਆਂ ਆਪੇ ਬੁੱਕ ਕਰੂੰਗਾ ਆਧਾਰ ਕਾਰਡ ਮੈਂ ਸਾਰਿਆਂ ਦੇ ਇਕੱਠੇ ਕਰ ਲਏ ਅਤੇ ਹੁਣ ਮੈਂ ਜਿਹੜਾ ਫਰੀ ਟਾਈਮ ਹੋ ਕੇ ਮੈਂ ਦੇਖਦਾ ਮੈਂ ਨਾਲ ਦੀ ਨਾਲ ਉਹ ਟਿਕਟਾਂ ਬੁੱਕ ਕਰ ਦੇਣੀਆਂ ਹੈਗੀਆਂ ਅਤੇ ਬਹੁਤ ਬਹੁਤ ਧੰਨਵਾਦ ਮੇਰੇ ਫਰੈਂਡ ਦਾ ਜਿਹਨੇ ਮੈਨੂੰ ਇੱਦਾਂ ਦਾ ਸਜੈਸਟ ਕੀਤਾ ਥੈਂਕ ਯੂ